ਸਰੀਰਕ ਕਸਰਤ ਅਤੇ ਯੋਗਾ ਵਿੱਚ ਕਾਫੀ ਸਾਰੇ ਬੁਨਿਆਦੀ ਫਰਕ ਹਨ ਸਰੀਰਕ ਕਸਰਤ ਆਮ ਤੌਰ 'ਤੇ ਸਰੀਰ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਵਾਸਤੇ ਦਿਮਾਗ ਨੂੰ ਚੁਕੰਨਾ ਰੱਖਣ ਵਾਸਤੇ ਅਤੇ ਸਰੀਰ ਦੇ ਮਸਲ ਮਾਸਪੇਸ਼ੀਆਂ ਨੂੰ ਮਜਬੂਤ ਔਰ ਉਹਨਾਂ ਦੀ ਅੱਛੀ ਸ਼ੇਪ ਲਿਆਉਣ ਵਾਸਤੇ ਕੀਤੀ ਜਾਂਦੀ ਹੈ ਅਤੇ ਜਿੱਥੇ ਯੋਗਾ ਦਾ ਸਵਾਲ ਹੈ ਯੋਗਾ ਜੋ ਹੈ ਉਹ ਥੋੜ੍ਹਾ ਜਿਹਾ ਸਰੀਰਕ ਕਸਰਤ ਨਾਲੋਂ ਅਲੱਗ ਇਸ ਤਰ੍ਹਾਂ ਹੈ ਕਿ ਸਰੀਰਕ ਕਸਰਤ ਜਿਹੜੀ ਹੈ ਉਹ ਥੋੜ੍ਹੀ ਤੇਜ਼ੀ ਨਾਲ ਹੁੰਦੀ ਹੈ ਅਤੇ ਯੋਗਾ ਦੇ ਸਾਰੇ ਆਸਨ ਬਹੁਤ ਹੀ ਆਰਾਮ ਨਾਲ ਅਤੇ ਹੌਲੀ ਹੌਲੀ ਕੀਤੇ ਜਾਂਦੇ ਹਨ ਅਤੇ ਯੋਗਾ ਦੇ ਆਸਨ ਜਿਹੜੇ ਨੇ ਇਹ ਵੱਖ ਵੱਖ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਵੀ ਬਹੁਤ ਲਾਭਦਾਇਕ ਅਤੇ ਸਹਾਇਕ ਹੁੰਦੇ ਹਨ